ਭੰਗੜੇ ਵਿੱਚ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਦੇ ਕੁੜਤੇ ਚਾਦਰੇ ਅਤੇ ਟੌਹਰੇ ਵਾਲੀਆਂ ਪੱਗਾਂ ਅਤੇ ਨਾਲ ਢੋਲ ਵਾਲਾ ਬਹੁਤ ਹੀ ਮਨਮੋਹਕ ਦ੍ਰਿਸ਼ ਹੁੰਦਾ ਹੈ ਜੋ ਕਿ ਲੜਕੀਆਂ ਦੇ ਲਹਿੰਗੇ ਪਾਏ ਹੁੰਦੇ ਹਨ ਅਤੇ ਉਹਨਾਂ ਦੇ ਬਹੁਤ ਹੀ ਚਮਕ ਦਮਕ ਵਾਲੇ ਪਹਿਰਾਵਾ ਪਹਿਨਿਆ ਹੁੰਦਾ ਹੈ ਅਤੇ ਗੂੜੇ ਰੰਗ ਦੇ ਕੱਪੜੇ ਹੋਣ ਕਾਰਨ ਉਹ ਬਹੁਤ ਹੀ ਲੋਕਾਂ ਦਾ ਧਿਆਨ ਆਕਰਸ਼ਿਤ ਕਰਦੇ ਹਨ ਅਤੇ ਉਹਨਾਂ ਦੀਆਂ ਭੰਗੜੇ ਦੀਆਂ ਟੀਮਾਂ ਨੂੰ ਪਹਿਲਾਂ ਕੋਚ ਵੱਲੋਂ ਸਮਝਾਇਆ ਜਾਂਦਾ ਹੈ ਸਿਖਾਇਆ ਜਾਂਦਾ ਹੈ ਅਤੇ ਉਹ ਟ੍ਰੇਨਿੰਗ ਅਨੁਸਾਰ ਸਾਰੇ ਇੱਕ ਲੜੀ ਦੌਰਾਨ ਚੱਲਦੇ ਹਨ ਜੋ ਕਿ ਉਹਨਾਂ ਦਾ ਦ੍ਰਿਸ਼ ਭੰਗੜੇ ਦਾ ਬਹੁਤ ਹੀ ਮਨਮੋਹਕ ਹੁੰਦਾ ਹੈ ਅਤੇ ਬਹੁਤ ਹੀ ਉਹ ਮਿਹਨਤ ਕਰਦੇ ਹਨ ਉਹਨਾਂ ਦੀ ਮਿਹਨਤ ਦੇ ਕਰਕੇ ਦਰਸ਼ਕ ਵੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ ਭੰਗੜਾ ਇੱਕ ਪ੍ਰਾਚੀਨ ਪ੍ਰਾਣੀ ਪੁਰਾਣੀ ਕਲਾ ਹੈ ਜੋ ਕਿ ਪੰਜਾਬੀ ਇਸ ਨੂੰ ਬਹੁਤ ਪਸੰਦ ਕਰਦੇ ਹਨ ਭੰਗੜਾ ਅਤੇ ਗਿੱਧਾ ਇਹ ਪਹਿਲੋਂ ਪਹਿਲਾਂ ਸਟੇਜਾਂ ਉੱਤੇ ਸਭ ਤੋਂ ਪਹਿਲਾਂ ਇਹ ਚਲਾਇਆ ਜਾਂਦਾ ਸੀ ਅਤੇ ਬਾਅਦ ਵਿੱਚ ਕੋਈ ਵੀ ਪ੍ਰੋਗਰਾਮ ਰੱਖਿਆ ਜਾਂਦਾ ਖੁਸ਼ੀ ਵਿੱਚ ਭੰਗੜਾ ਅਤੇ ਗਿੱਧਾ ਜ਼ਰੂਰ ਭੰਗੜਾ ਪਾਇਆ ਜਾਂਦਾ ਹੈ ਪੰਜਾਬ ਨਾਲ ਭੰਗੜੇ ਨਾਲ ਪੰਜਾਬ ਦੀ ਆਣ ਬਾਣ ਸ਼ਾਨ ਵੱਧਦੀ ਹੈ ਭੰਗੜਾ ਬਹੁਤ ਹੀ ਵਧੀਆ ਹੈ ਅਤੇ ਪੰਜਾਬੀ ਇਸ ਨੂੰ ਬਹੁਤ ਪਸੰਦ ਕਰਦੇ ਹਨ